ਸਰ ਮੈਨੂੰ ਇੱਥੇ ਉਤਾਰ ਦਿਓ ਕਿਉਂਕਿ ਮੇਰੀ ਮੰਜ਼ਿਲ ਆ ਚੁੱਕੀ ਹੈ ਮੈਂ ਇੱਥੇ ਹੀ ਉਤਰਨਾ ਹੈ ਮੇਰਾ ਭੁਗਤਾਨ ਕੈਸ਼ ਵਿੱਚ ਲੈ ਲਵੋ ਮੇਰੇ ਕੋਲ ਨਾ ਤਾਂ ਕਰੈਡਿਟ ਕਾਰਡ ਹੈਗਾ ਨਾ ਕੈ ਕੈਸ਼ ਵਿੱਚ ਮੈਂ ਤੁਹਾਨੂੰ ਪੈਸੇ ਦੇ ਸਕਦੀ ਹਾਂ ਕਿਉਂਕਿ ਮੇਰਾ ਫੋਨ ਵੀ ਘਰ ਵਿੱਚ ਰਹਿ ਚੁੱਕਿਆ ਹੈ ਮੇਰੇ ਕੋਲ ਛੋਟਾ ਬਟਨਾਂ ਵਾਲਾ ਫੋਨ ਹੈ ਇਹਦੇ ਵਿੱਚ ਇੰਟਰਨੈਟ ਦੀ ਸੁਵਿਧਾ ਨਹੀਂ ਹੈ ਨਾ ਹੀ ਮੈਂ ਤੁਹਾਨੂੰ ਸਕੈਨ ਕਰ ਸਕਦੀ ਹਾਂ ਨਾ ਹੀ ਕੋਈ ਹੋਰ ਸੁਵਿਧਾ ਤੁਸੀਂ ਸਾਰੇ ਹੀ ਤਰ੍ਹਾਂ ਦਾ ਭੁਗਤਾਨ ਲਿਆ ਕਰੋ ਕਿਉਂਕਿ ਨਾ ਤਾਂ ਸਾਰੇ ਲੋਕ ਪੜ੍ਹੇ ਲਿਖੇ ਹੁੰਦੇ ਹਨ ਨਾ ਹੀ ਕਿਸੇ ਕੋਲ ਵੱਡਾ ਫੋਨ ਕਈਆਂ ਕੋਲ ਨਹੀਂ ਹੁੰਦਾ ਜਿਸ ਨਾਲ ਤੁਹਾਨੂੰ ਸਕੈਨ ਕਰ ਸਕਣ ਤੁਹਾਨੂੰ ਸਾਰਿਆਂ ਨੂੰ ਇੱਕੋ ਜਿਹੀ ਡਿਲੀਵਰੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਸਾਰੇ ਨਗਦ ਜਾਂ ਕੈਸ਼ ਵਿੱਚ ਵੀ ਪੈਸੇ ਦੇ ਸਕਣ ਤੁਹਾਨੂੰ ਚਾਹੀਦਾ ਹੈ ਕਿ ਹਰੇਕ ਗਾਹਕ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਤੁਹਾਨੂੰ ਕੈਸ਼ ਵੀ ਲੈਣਾ ਚਾਹੀਦਾ ਹੈ ਅਤੇ ਔਨਲਾਈਨ ਪੇਅ ਵੀ ਕਰਵਾਉਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਬਜ਼ੁਰਗ ਜਾਂ ਮਜ਼ਦੂਰ ਲੋਕਾਂ ਕੋਲ ਨਾ ਤਾਂ ਵੱਡਾ ਫੋਨ ਹੁੰਦਾ ਹੈ ਅਤੇ ਨਾ ਹੀ ਉਹ ਜ਼ਿਆਦਾ ਪੜ੍ਹੇ ਲਿਖੇ ਹੋਣ ਜਿਸ ਨਾਲ ਉਹ ਤੁਹਾਨੂੰ ਸਕੈਨ ਕਰ ਸਕਣ ਕਿਰਪਾ ਕਰਕੇ ਮੇਰਾ ਭੁਗਤਾਨ ਤੁਸੀਂ ਹੁਣ ਕੈਸ਼ ਵਿੱਚ ਹੀ ਲੈ ਲਵੋ ਧੰਨਵਾਦ